ਜਦੋਂ ਪੰਛੀ ਆਪਣੇ ਸ਼ੁਰੂਆਤੀ ਦੌਰ ਵਿੱਚ ਹੁੰਦੇ ਹਨ ਤਾਂ ਅਸੀਂ ਉਹਨਾਂ ਲਈ ਦਾਣਾ ਅਤੇ ਪਾਣੀ ਦਾ ਬਿਲਕੁਲ ਕੋਲ ਦੇ ਖੇਤਰ ਵਿੱਚ ਇੰਤਜ਼ਾਮ ਕਰ ਸਕਦੇ ਹਾਂ ਅਸੀਂ ਉਹਨਾਂ ਦੇ ਲਈ ਅਲੱਗ ਅਲੱਗ ਤਰ੍ਹਾਂ ਦੇ ਚੀਜ਼ਾਂ ਖਾਣ ਵਾਲੀਆਂ ਜੋ ਹਨ ਉਹ ਦੇ ਸਕਦੇ ਹਾਂ ਉਹਨਾਂ ਨੂੰ ਰੋਜ਼ ਰੋਜ਼ ਦੇਖਦੇ ਹਾਂ ਕਿ ਕਿਤੇ ਉਹਨਾਂ ਨੂੰ ਕੋਈ ਖਤਰਾ ਤਾਂ ਨਹੀਂ ਉਹਨਾਂ ਨੂੰ ਪੂਰੀ ਤਰ੍ਹਾਂ ਹਿਫਾਜ਼ਤ ਨਾਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹਨਾਂ ਦੇ ਮਾਂ ਬਾਪ ਅਰਥਾਤ ਉਹਨਾਂ ਦੇ ਛੋਟੇ ਬੱਚਿਆਂ ਦੇ ਪੰਛੀਆਂ ਦੇ ਮਾਂ ਬਾਪ ਕਿਤੇ ਦਾਣਾ ਚੁਗਣ ਜਾਂਦੇ ਹਨ ਉਹ ਦੇ ਭੋਜਨ ਲਿਆਏ ਇੰਤਜ਼ਾਮ ਕਰਨ ਨਾਲ ਉਹਨਾਂ ਨੂੰ ਆਸਾਨੀ ਨਾਲ ਕੋਲ ਹੀ ਪਿਆ ਖਾਣ ਪੀਣ ਦਾ ਸਮਾਨ ਮਿਲ ਜਾਏਗਾ ਜਿਸ ਨਾਲ ਉਹ ਪੰਛੀ ਆਪਣੇ ਨਵਜਾਤ ਬੱਚੇ ਨੂੰ ਆਰਾਮ ਨਾਲ ਅਤੇ ਵਧੀਆ ਤਰੀਕੇ ਨਾਲ ਭੋਜਨ ਉਪਲਬਧ ਕਰਾ ਸਕਦੇ ਹਨ ਇਸ ਨਾਲ ਉਹਨਾਂ ਦਾ ਉਹਨਾਂ ਦੀ ਰੱਖਿਆ ਵੀ ਹੋਏਗੀ ਅਤੇ ਉਹਨਾਂ ਲਈ ਇੱਕ ਅੱਛਾ ਵਾਤਾਵਰਨ ਵੀ ਬਣੇਗਾ ਉਹਨਾਂ ਲਈ ਇੱਕ ਹੋਰ ਸੁਝਾਅ ਦਿੱਤਾ ਜਾ ਸਕਦਾ ਹੈ ਕਿ ਮੇਰੇ ਮੁਤਾਬਿਕ ਉਹਨਾਂ ਲਈ ਹਲਕਾ ਜਿਹਾ ਮਿਊਜਿਕ ਜਾਂ ਫਿਰ ਸੰਗੀਤ ਰੋਜ਼ ਸਵੇਰੇ ਸ਼ਾਮ ਲਗਾਇਆ ਜਾਵੇ ਤਾਂ ਜੋ ਉਹਨਾਂ ਨੂੰ ਵੀ ਉਸ ਵਾਤਾਵਰਨ ਵਿੱਚ ਅੱਛਾ ਲੱਗੇ